ਸਤਿ ਸ਼੍ਰੀ ਅਕਾਲ ਜੀ ਜੀ ਹਾਂ ਅਸੀਂ ਇੱਕ ਲੰਬੀ ਯਾਤਰਾ 'ਤੇ ਜਾਣਾ ਸੁਨਿਸ਼ਚਿਤ ਕੀਤਾ ਹੈ ਸਾਡੇ ਮੋਬਾਇਲ ਫੋਨ ਦਾ ਸਿਸਟਮ ਬਿਲਕੁਲ ਸੰਤੁਲਿਤ ਹੈ ਜੇਕਰ ਐਮਰਜੈਂਸੀ ਹੋ ਵੀ ਗਈ ਤਾਂ ਸਾਡਾ ਫੋਨ ਪੂਰਾ ਵਧੀਆ ਤਰੀਕੇ ਨਾਲ ਕੰਮ ਕਰ ਸਕਦਾ ਹੈ ਅਤੇ ਰੀਚਾਰਜ ਕਰਨ ਲਈ ਗੂਗਲ ਪੇ ਦੀ ਵਰਤੋਂ ਕਰਕੇ ਨੰਬਰ ਸੱਤ ਪੰਜ ਜ਼ੀਰੋ ਇੱਕ ਚਾਰ ਦੋ ਇੱਕ ਚਾਰ ਜ਼ੀਰੋ ਇੱਕ ਇਸ ਨੰਬਰ 'ਤੇ ਅਸੀਂ ਆਪਣਾ ਫੋਨ ਰੀਚਾਰਜ ਕਰਵਾ ਸਕਦੇ ਹਾਂ ਧੰਨਵਾਦ